ਮੇਰੇ ਅਨੁਸਾਰ ਤਾਂ ਜਿਹੜੀ ਕਹਿ ਸਕਦੇ ਹਾਂ ਪ੍ਰੈਕਟੀਕਲ ਜਿਹੜੀ ਜਾਣਕਾਰੀ ਹੈਗੀ ਹੈ ਨਾ ਉਹ ਬਹੁਤ ਹੀ ਮਹੱਤਵਪੂਰਨ ਪ੍ਰਭਾਵ ਪਾ ਸਕਦੀ ਆ ਭਵਿੱਖ ਦੇ ਵਿੱਚ ਆਉਣ ਵਾਲੇ 'ਚ ਜਿਵੇਂ ਕਿ ਆਪਾਂ ਕਹਿ ਦਈਏ ਵੀ ਜਿਵੇਂ ਜਿਵੇਂ ਰੱਟਾਫਿਕੇਸ਼ਨ ਹੈਗਾ ਨਾ ਉਹਦੇ ਨਾਲ ਕੀ ਆ ਆਪਾਂ ਉਹਨੂੰ ਜਸਟ ਇੱਕ ਯਾਦ ਆਪਾਂ ਉਹਨੂੰ ਸਿਰਫ ਇੱਕ ਯਾਦ ਕਰ ਲੈਂਦੇ ਹਾਂ ਨਾ ਮਾਮੂਲੀ ਤੌਰ 'ਤੇ ਹੈ ਨਾ ਜੇ ਆਪਾਂ ਕਿਸੇ ਚੀਜ਼ ਨੂੰ ਸਮਝ ਕੇ ਕਰਦੇ ਹੈਗੇ ਹੈ ਨਾ ਤਾਂ ਉਹ ਚੀਜ਼ ਕੀ ਆ ਆਪਣੇ 'ਤੇ ਧੁਰ ਰਹਿੰਦੀ ਆਪਣੇ ਦਿਮਾਗ ਦੇ ਅੰਦਰ ਹੈ ਨਾ ਪ੍ਰੈਕਟੀਕਲੀ ਜਦੋਂ ਆਪਾਂ ਉਸ ਚੀਜ਼ ਨੂੰ ਵਰਤ ਦਿਆਂਗੇ ਜਾਂ ਉਸ ਚੀਜ਼ ਨੂੰ ਹੰਡਾਉਣੇ ਹੈਗੇ ਤਾਂ ਉਹ ਚੀਜ਼ ਕੀ ਹੈ ਜ਼ਿਆਦਾ ਅਸਰਦਾਰ ਹੁੰਦੀ ਹੈਗੀ ਅਤੇ ਭਵਿੱਖ ਦੇ ਵਿੱਚ ਸਭ ਤੋਂ ਵੱਧ ਜਿਹੜੀ ਆਪਾਂ ਕਹਿ ਸਕਦੇ ਹਾਂ ਵਿਕਾਸ ਅਤੇ ਸਫਲਤਾ ਲਈ ਜਿਹੜੀ ਮਹੱਤਵਪੂਰਨ ਜਿਹੜੀ ਕਹਿ ਸਕਦੇ ਹਾਂ ਕਿ ਇੱਕ ਜਗ੍ਹਾ ਆਪਾਂ ਇੱਕ ਹਿੱਸਾ ਕਹਿ ਸਕਦੇ ਹੈਗੇ ਹੈ ਨਾ ਇੱਕ ਪ੍ਰੈਕਟੀਕਲ ਨੌਲੇਜ ਹੀ ਆ ਕਿਸੇ ਵੀ ਵਿਸ਼ੇ ਦੇ ਲੈ ਕੇ ਹੈ ਨਾ ਆਪਾਂ ਉਹਦਾ ਕੋਈ ਵੀ ਜੋ ਵਿਸ਼ਾ ਤੁਸੀਂ ਕਹਿ ਲਓ ਚਾਹੇ ਹੈ ਨਾ ਅਤੇ ਜਿਵੇਂ ਹੁਣ ਅੱਜ ਦੇ ਟਾਈਮ ਦੀ ਆਪਾਂ ਗੱਲ ਕਰੀਏ ਅਤੇ ਜਿਵੇਂ ਆਪਾਂ ਕਹਿ ਸਕਦੇ ਹੈਗੇ ਸਿੱਖਣਾ ਕੁਛ ਲਰਨਿੰਗ ਕਰਨੀ ਹੈ ਨਾ ਜਿਵੇਂ ਬੱਚਿਆਂ ਨੂੰ ਹੈ ਨਾ ਆਪਾਂ ਕੀ ਆ ਵੀ ਲਰਨਿੰਗ ਕਿਵੇਂ ਕਰਾਉਣੀ ਆ ਨਾ ਇਹਦੀ ਕੋਈ ਵੀ ਚੀਜ਼ ਸਿੱਖਣ ਦੀ ਪ੍ਰਕਿਰਿਆ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਾ ਜਿਵੇਂ ਪਹਿਲਾਂ ਆਪਾਂ ਪਰੰਪਰਾਗਤ ਜਿਹੜੇ ਤਰੀਕੇ ਯੂਜ਼ ਵਰਤਦੇ ਸੀਗੇ ਹੈ ਨਾ ਉਹਦੀ ਜਗ੍ਹਾ 'ਤੇ ਹੁਣ ਨਵੀਆਂ ਨਵੀਆਂ ਤਕਨੀਕਾਂ ਵਰਤਣੀਆਂ ਚਾਹੀਦੀਆਂ ਨੇ ਅਲੱਗ ਅਲੱਗ ਕੀ ਆਪਾਂ ਨੂੰ ਇੱਕ ਤਰ੍ਹਾਂ ਦੀ ਅਲੱਗ ਅਲੱਗ ਪ੍ਰੋਜੈਕਟ ਕਹਿ ਸਕਦੇ ਜੇ ਅਲੱਗ ਅਲੱਗ ਕਿਸਮਾਂ ਵਰਤਣੀਆਂ ਚਾਹੀਦੀਆਂ ਨੇ ਜਿਵੇਂ ਕਿ ਬੱਚਿਆ ਨੂੰ ਜਿਵੇਂ ਅੱਜ ਦੇ ਟਾਈਮ ਦੀ ਮਤਲਬ ਬੱਚੇ ਕੀ ਨੇ ਜ਼ਿਆਦਾਤਰ ਕੀ ਆਪਾਂ ਜੇ ਜੇ ਕੋਈ ਚੀਜ਼ ਆਪਣੇ ਸਾਹਮਣੇ ਹੈ ਨਾ ਤਸਵੀਰ ਰਾਹੀਂ ਪੇਸ਼ ਹੁੰਦੀਆਂ ਤਾਂ ਉਹ ਉਹ ਚੀਜ਼ ਕੀ ਆਪਣੀ ਜ਼ਿਆਦਾ ਤਾਂ ਅਸਰ ਆਪਣੇ ਦਿਮਾਗ 'ਤੇ ਜ਼ਿਆਦਾ ਅਸਰਦਾਰ ਕਰਦੀਆਂ ਨਾ ਮਤਲਬ ਕਿ ਬਾਕੀ ਹੋਰ ਚੀਜ਼ਾਂ ਨਾਲੋਂ ਉਹ ਜ਼ਿਆਦਾ ਅਸਰਦਾਰ ਹੁੰਦੀ ਹੈਗੀ ਹੈ ਨਾ ਤਾਂ ਮਤਲਬ ਕਿ ਕੋਸ਼ਿਸ਼ ਕਰੋ ਕਿ ਆਪਾਂ ਨੂੰ ਮਤਲਬ ਕਿ ਇਹੋ ਜਿਹੇ ਜਿਹੜੇ ਪੁਆਇੰਟ ਨੇ ਜਾਂ ਫਿਰ ਹੈ ਨਾ ਇਹੋ ਜਿਹੇ ਕਿਸਮ ਨੇ ਨਾ ਇਹੋ ਜਿਹੇ ਅਪਣਾਉਣੇ ਚਾਹੀਦੇ ਨੇ ਵੀ ਜਿਹਨਾਂ ਦਾ ਲੰਮਾ ਸਮਾਂ ਆਪਣੇ 'ਤੇ ਅਸਰ ਰਹੇ